ਮੇਰੇ ਮਨ ਪਸੰਦ ਲੇਖਕ ਨਰਿੰਦਰ ਕਪੂਰ ਜੀ ਹਨ ਮੈਨੂੰ ਇਹਨਾਂ ਦੀਆਂ ਕਿਤਾਬਾਂ ਪੜ੍ਹਨੀਆਂ ਬੜੀਆਂ ਪਸੰਦ ਲੱਗਦੀਆਂ ਹਨ ਇਹਨਾਂ ਦੀ ਕਿਤਾਬਾਂ ਜਿਵੇਂ ਖਿੜਕੀਆਂ ਇਹਨਾਂ ਦੇ ਵਿੱਚ ਇਹਨਾਂ ਦੀ ਲਿਖਤ ਬੜੀ ਪਸੰਦ ਹੈ ਜੋ ਕਿ ਅਲੱਗ ਅਲੱਗ ਕਿਰਦਾਰਾਂ ਦੇ ਬਾਰੇ ਦੱਸੀ ਜਾਂਦੀ ਹੈ